ਜੇਕਰ ਅਸੀਂ ਗਾਰਡਨਿੰਗ ਦੀ ਗੱਲ ਕਰੀਏ ਤਾਂ ਗਾਰਡਨਿੰਗ ਹੈ ਜਿਹੜੀ ਉਹ ਕਾਫੀ ਕਿਸਮਾਂ ਦੀ ਮਿਲਦੀ ਹੈ ਸਾਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਜਗ੍ਹਾ ਦੇ ਅਧਾਰ 'ਤੇ ਵੀ ਜਿਹੜੀ ਗਾਰਡਨਿੰਗ ਹੈ ਉਹਦੀਆਂ ਵੱਖ ਵੱਖ ਕਿਸਮਾਂ ਮਿਲਦੀਆਂ ਨੇ ਜਿਵੇਂ ਅਸੀਂ ਜੇਕਰ ਦੇਖੀਏ ਤਾਂ ਸ਼ਹਿਰਾਂ ਦੇ ਵਿੱਚ ਸਾਡੇ ਕੋਲ ਜਿਹੜੀ ਜਗ੍ਹਾ ਉਹਦੀ ਕਾਫੀ ਜ਼ਿਆਦਾ ਕਮੀ ਹੁੰਦੀ ਹੈ ਇਸ ਲਈ ਅਸੀਂ ਜੋ ਸਾਡੇ ਕੋਲ ਮੌਜੂਦ ਥਾਵਾਂ ਹੁੰਦੀਆਂ ਉੱਥੇ ਜਿਵੇਂ ਉਦਾਹਰਣ ਦੇ ਲਈ ਅਸੀਂ ਗੱਲ ਕਰੀਏ ਛੱਤ ਸਾਡੇ ਕੋਲ ਉੱਥੇ ਮੌਜੂਦ ਹੁੰਦੀ ਹੈ ਤਾਂ ਅਸੀਂ ਉੱਥੇ ਟੈਰਿਸ ਗਾਰਡਨਿੰਗ ਆ ਜਿਹੜੀ ਉਹ ਕਰਦੇ ਹੈਗੇ ਕਿਉਂਕਿ ਉੱਥੇ ਸਾਡੇ ਕੋਲ ਉੱਥੇ ਕਾਫੀ ਖੁੱਲ੍ਹੀ ਜਗ੍ਹਾ ਜਿਹੜੀ ਉਹ ਮਿਲ ਜਾਂਦੀ ਹੈਗੀ ਉੱਥੇ ਅਸੀਂ ਗਮਲਿਆਂ ਦੇ ਵਿੱਚ ਜਾਂ ਹੋਰ ਜਿਹੜੇ ਵੱਡੇ ਸਾਡੇ ਕੋਲ ਮੈਟ ਆਉਂਦੇ ਹੈਗੇ ਖੇਤੀ ਦੇ ਲਈ ਗਾਰਡਨਿੰਗ ਦੇ ਲਈ ਉਹਦੇ ਵਿੱਚ ਅਸੀਂ ਜਿਹੜੀਆਂ ਸਬਜ਼ੀਆਂ ਹੈਗੀਆਂ ਉਹ ਉਗਾਉਂਦੇ ਹੈਗੇ ਜੇਕਰ ਅਸੀਂ ਗੱਲ ਕਰੀਏ ਆਮ ਗਾਰਡਨਿੰਗ ਦੀ ਤਾਂ ਸਾਡੇ ਕੋਲ ਨੀਚੇ ਵਿਹੜੇ ਦੇ ਵਿੱਚ ਜਾਂ ਸਾਡੀ ਜਿਹੜਾ ਕੋਈ ਪਾਰਕ ਲਈ ਜਗ੍ਹਾ ਛੱਡੀ ਹੋਈ ਆ ਘਰ ਦੇ ਵਿੱਚ ਉੱਥੇ ਸਾਡੇ ਲਈ ਕੋਲ ਜਿਹੜੀ ਜਗ੍ਹਾ ਹੁੰਦੀ ਹੈ ਜਿੱਥੇ ਅਸੀਂ ਧਰਤੀ ਦੇ ਵਿੱਚ ਬੀਜ ਬੀਜਦੇ ਐਂਗੇ ਉਹ ਸਾਡੇ ਕੋਲ ਆਮ ਗਾਰਡਨਿੰਗ ਆ ਜਾਂਦੀ ਹੈ ਜਦਕਿ ਅਸੀਂ ਜਿਹੜੀ ਟੈਰਰਸ ਗਾਰਡਨਿੰਗ ਹੈ ਉਹਦੇ ਵਿੱਚ ਅਸੀਂ ਗਮਲਿਆਂ ਦੇ ਵਿੱਚ ਹੈ ਜਿਹੜੀ ਉਹ ਖੇਤੀ ਕਰਦੇ ਹਾਂ